ਤੀਹ ਦਸੰਬਰ ਉੱਨੀ ਸੌ ਪਚਾਸੀ ਇੱਕ ਨਵੰਬਰ ਦੋ ਹਜ਼ਾਰ ਇੱਕ ਇੱਕ ਸਤੰਬਰ ਦੋ ਹਜ਼ਾਰ ਵੀਹ ਇੱਕ ਅਕਤੂਬਰ ਵੀਹ ਸੌ ਤੇਈ ਇੱਕ ਜਨਵਰੀ ਵੀਹ ਸੌ ਇੱਕੀ